ਬੜੀ ਠੰਡਾ ਹੈ ਅਤੇ ਲਾਈਟ ਚਲੀ ਗਈ ਕਿਸ ਤਰ੍ਹਾਂ ਆਪਣਾ ਕੋਈ ਵੀ ਹੀਟਰ ਵਗੈਰਾ ਨਹੀਂ ਲੱਗਣਾ ਫੋਨ ਚੈੱਕ ਕਰਦੇ ਹਾਂ ਫੋਨ ਦੇ ਵਿੱਚ ਕੋਈ ਮੈਸੇਜ ਨਹੀਂ ਬਿਜਲੀ ਬੋਰਡ ਵੱਲੋਂ ਇਹ 'ਚ ਜਿਹੜੀ ਤੁਹਾਡੀ ਲਾਈਟ ਆ ਉਹ ਬੰਦ ਰਹੇਗੀ ਫੋਨ ਕਰਦੇ ਹਾਂ ਸਰ ਅੱਜ ਸਾਡੇ ਇਲਾਕੇ ਦੇ ਵਿੱਚ ਲਾਈਟ ਨਹੀਂ ਹੈਗੀ ਅਤੇ ਠੰਡ ਬਹੁਤ ਹੈ 'ਤੇ ਅਸੀਂ ਖਾਣਾ ਵਗੈਰਾ ਵੀ ਗਰਮ ਨਹੀਂ ਕਰ ਪਾ ਰਹੇ ਕਿਉਂਕਿ ਲੈ ਬਿਜਲੀ ਤੋਂ ਬਿਨ੍ਹਾਂ ਇਹ ਕੰਮ ਹੋਣਾ ਨਹੀਂ ਅਤੇ ਕਿਸੇ ਤਰ੍ਹਾਂ ਦਾ ਸਾਡਾ ਹੀਟਰ ਵਗੈਰਾ ਨਹੀਂ ਚੱਲ ਰਹੇ ਕੀ ਤੁਸੀਂ ਦੱਸ ਸਕਦੇ ਹੋ ਕਕਿ ਜਿਹੜੀ ਲਾਈਟ ਹੈ ਉਹ ਕਿੰਨੇ ਕੁ ਸਮੇਂ ਦੇ ਵਿੱਚ ਆਵੇਗੀ ਕਿਉਂਕਿ ਐਮਰਜੈਂਸੀ ਵਾਲੇ ਹਾਲਾਤ ਨੇ ਅਤੇ ਕੋਸ਼ਿਸ਼ ਕਰੋ ਕਿ ਤੁਸੀਂ ਜਲਦੀ ਤੋਂ ਜਲਦੀ ਇਹ ਜਿਹੜੀ ਲਾਈਟ ਹੈ ਠੀਕ ਕਰਵਾ ਦਿਉ ਤਾਂ ਕਿ ਅਸੀਂ ਆਪਣੇ ਕੰਮ ਕਾਰ ਨੇ ਉਹ ਜਿਹੜੇ ਕਰ ਸਕੀਏ ਅਤੇ ਕਿਉਂਕਿ ਠੰਡ ਬਹੁਤ ਜ਼ਿਆਦਾ ਇੰਨੀ ਠੰਡ ਦੇ ਵਿੱਚ ਬਿਨ੍ਹਾਂ ਲਾਈਟ ਤੋਂ ਸਰਵਾਈਵ ਨਹੀਂ ਹੋਣਾ ਬੇਨਤੀ ਹੈ ਕਿ ਜਲਦੀ ਤੋਂ ਜਲਦੀ